ਅੱਜ ਕੱਲ੍ਹ ਦੇ ਦੌਰ ਵਿੱਚ ਭਾਰਤ ਦੀ ਆਵਾਜਾਈ ਬਹੁਤ ਹੀ ਭੀੜ ਭੜੱਕੇ ਵਾਲੀ ਹੋ ਗਈ ਹੈ ਲੋਕਾਂ ਨੇ ਜੇ ਨੇੜੇ ਵਾਲੀ ਥਾਂ ਵੀ ਜਾਣਾ ਹੁੰਦਾ ਹੈ ਤਾਂ ਵੀ ਉਹ ਆਪਣੇ ਵਹੀਕਲ ਦੀ ਵਰਤੋਂ ਕਰਦੇ ਨੇ ਬਜ਼ਾਰਾਂ ਵਿੱਚ ਵੀ ਵਹੀਕਲਾਂ ਕਰਕੇ ਬਹੁਤ ਹੀ ਟਰੈਫਿਕ ਹੋ ਜਾਂਦਾ ਹੈ ਅਤੇ ਇਹ ਇੱਕ ਐਕਸੀਡੈਂਟ ਦਾ ਕਾਰਨ ਵੀ ਬਣਦੇ ਨੇ ਅਤੇ ਮੈਂ ਸਰਕਾਰ ਨੂੰ ਇਹ ਬੇਨਤੀ ਕਰਾਂਗੀ ਕਿ ਨਵੇਂ ਹਾਈਵੇ ਬਣਾਏ ਜਾਣ ਰੋਡ ਬਣਾਏ ਜਾਣ ਤਾਂ ਕਰਕੇ ਜ਼ਿਆਦਾ ਬਜ਼ਾਰਾਂ ਵਿੱਚ ਟਰੈਫਿਕ ਨਾ ਹੋਵੇ ਅਤੇ ਐਕਸੀਡੈਂਟ ਨਾ ਹੋਣ ਧੰਨਵਾਦ